ਹਾਂ ਸਾਡੇ ਫਾਜ਼ਿਲਕਾ ਵਿੱਚ ਅਗਲਾ ਡਾਂਸ ਅਕੈਡਮੀ ਹੈ ਗੁਰਬਖਸ਼ ਡਾਂਸ ਅਕੈਡਮੀ ਹੈ ਉਹਨਾਂ ਨੇ ਸਾਡੇ ਡਾਂਸ ਦੇ ਪ੍ਰਦਰਸ਼ਨ ਨੂੰ ਸੁਧਾਰਨ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਹਨਾਂ ਨੇ ਸਾਡੇ ਡਾਂਸ ਵਿੱਚ ਬਹੁਤ ਸੁਧਾਰ ਕੀਤੇ ਅਤੇ ਉਹਨਾਂ ਦਾ ਡਾਂਸ ਨੂੰ ਇੱਕ ਬਹੁਤ ਵੱਡੀ ਦੇਣ ਹੈ ਅਤੇ ਜੇਕਰ ਅਸੀਂ ਡਾਂਸ ਦੇ ਕਿਸੇ ਨੂੰ ਉਤਸ਼ਾਹਿਤ ਕਰਨਾ ਹੋਵੇ ਤਾਂ ਅਸੀਂ ਡਾਂਸ ਦੇ ਫਾਇਦੇ ਦੱਸਾਂਗੇ ਬੱਚਿਆਂ ਨੂੰ ਦੱਸਾਂਗੇ ਕਿ ਡਾਂਸ ਇੱਕ ਬਹੁਤ ਵਡ ਵਧੀਆ ਐਕਸਰਸਾਈਜ਼ ਹੈ ਡਾਂਸ ਨਾਲ ਦਿਮਾਗ ਤੇਜ਼ ਅ ਤੰਦਰੁਸਤ ਰਹਿੰਦਾ ਅਤੇ ਡਾਂਸ ਕਰਨ ਨਾਲ ਬੱਚੇ ਮੋਬਾਈਲਾਂ ਤੋਂ ਥੋੜ੍ਹੀ ਸਾਈਟ ਹੋ ਕੇ ਆਪਣਾ ਮਨੋਰੰਜਨ ਵੀ ਕਰ ਸਕਣਗੇ ਅਤੇ ਆਪਣੇ ਦਿਮਾਗੀ ਥਕਾਵਟ ਨੂੰ ਵੀ ਹਟਾ ਸਕਣਗੇ ਇਸ ਕਰ ਡਾਂਸ ਕਰਨਗੇ ਬੱਚੇ ਅਗਰ ਜੇ ਬੱਚਿਆਂ ਦਾ ਡਾਂਸ ਵਿੱਚ ਇੰਟਰਸਟ ਹੋ ਜਾਵੇਗਾ ਅਤੇ ਫਿਰ ਬੱਚੇ ਆਪਣਾ ਮਤਲਬ ਡਾਂਸ ਕਰ ਕਰਕੇ ਥੱਕ ਜਾਣਗੇ ਅਤੇ ਉਹ ਮੋਬਾਈਲਾਂ ਤੋਂ ਦੂਰ ਰਹਿਣਗੇ ਬੱਚਿਆਂ ਨੂੰ ਡਾਂਸਾਂ ਦੇ ਫਾਇਦੇ ਦੱਸੋ ਉਹ ਗੁਰਬਖਸ਼ ਡਾਂਸ ਅਕੈਡਮੀ ਵੀ ਜਿਹੜੇ ਸਾਡੇ ਫਾਜ਼ਿਲਕਾ ਦੇ ਨੇ ਉਹ ਵੀ ਬੱਚਿਆਂ ਨੂੰ ਡਾਂਸ ਦੇ ਫਾਇਦੇ ਦੱਸਦੀ ਹੈ ਅਤੇ ਉੱਥੇ ਜਾ ਕੇ ਬੱਚੇ ਔਰ ਬੱ ਆਪਣੇ ਨਾਲ ਦੇ ਬੱਚਿਆਂ ਨੂੰ ਦੇਖਦੇ ਨੇ ਤਾਂ ਹੋਰ ਉਤਸ਼ਾਹਿਤ ਹੁੰਦੇ ਨੇ ਛੋਟੀ ਛੋਟੀ ਏਜ ਦੇ ਬੱਚੇ ਸ਼ੋਸ਼ਲ ਮੀਡੀਆ 'ਤੇ ਆਪਾਂ ਡਾਂਸ ਵੇਖਦੇ ਹਾਂ ਅਤੇ ਸ਼ੋਸ਼ਲ ਮੀਡੀਆ 'ਤੇ ਇਹਨਾਂ ਚੀਜ਼ਾਂ ਨੂੰ ਆਪਾਂ ਦੇ ਅ ਪਾ ਸਕਦੇ ਹਾਂ ਜਦੋਂ ਬੱਚੇ ਮੋਬਾਈਲ ਚਲਾਉਂਦੇ ਨੇ ਉਹਦੇ ਵਿੱਚ ਬੱਚਿਆਂ ਨੂੰ ਡਾਂਸ ਕਰਨ ਵੇਖਦੇ ਨੇ ਤਾਂ ਉਹਨਾਂ ਦਾ ਹੋਰ ਮਨ ਮਨ ਮਤਲਬ ਡਾਂਸ ਕਰਨ ਨੂੰ ਮਨ ਕਰਦਾ ਅਤੇ ਫਿਰ ਉਹਨਾਂ ਨੂੰ ਅਸੀਂ ਦੱਸਾਂਗੇ ਡਾਂਸ ਅਕੈਡਮੀ ਵਿੱਚ ਲੱਗ ਜਾਓ ਤੁਸੀਂ ਡਾਂਸ ਅਕੈਡਮੀ ਜਾਇਆ ਕਰੋ ਅਤੇ ਬੱਚੇ ਆਪ ਨੇ ਆਸ ਪਾਸ ਦੇ ਬੱਚੇ ਨੂੰ ਵੇਖ ਕੇ ਉਤਸ਼ਾਹਿਤ ਹੋਣਗੇ ਅਤੇ ਡਾਂਸ ਕਰਨ ਲਈ ਡਾਂਸ ਕਰਕੇ ਤੰਦਰੁਸਤ ਮਹਿਸੂਸ ਕਰਨਗੇ ਅਤੇ ਖੁਸ਼ੀ ਮਹਿਸੂਸ ਕਰਨਗੇ ਇਸ ਨਾਲ ਉਹਨਾਂ ਦਾ ਮਨ ਵੀ ਸ਼ਾਂਤ ਰਹੇਗਾ ਅਤੇ ਉਹ ਹੋਰ ਵੀ ਅ ਦੂਸਰੇ ਖਿਆਲਾਂ ਤੋਂ ਬਚ ਸਕਣਗੇ